ਮਨੋਰੰਜਨ ਲਈ ਪੰਜਾਬ ਵਿੱਚ ਬਹੁਤ ਸਾਰੀਆਂ ਜਗ੍ਹਾ ਹਨ ਜਿਵੇਂ ਕਿ ਰੋਪੜ ਵਿੱਚ ਵਿਸ਼ਾਲ ਮੌਲ ਹੈ ਜਿਸ ਵਿੱਚ ਘਰ ਦੀ ਜ਼ਰੂਰਤ ਦਾ ਹਰੇਕ ਸਮਾਨ ਮਿਲ ਜਾਂਦਾ ਹੈ ਜਿਵੇਂ ਕਿ ਬੱਚਿਆਂ ਦੇ ਕੱਪੜੇ ਘਰ ਦਾ ਰਾਸ਼ਨ ਘਰ ਦਾ ਰਾਸ਼ਨ ਔਰ ਕੋਈ ਵੀ ਸਮਾਨ ਮਿਲ ਜਾਂਦਾ ਹੈ ਉਸ ਤੋਂ ਇਲਾਵਾ ਖਰੜ ਵਿੱਚ ਵੀ ਆਰ ਮੌਲ ਹੈ ਜਿਸ ਵਿੱਚ ਹਰੇਕ ਸਮਾਨ ਮਿਲ ਜਾਂਦਾ ਹੈ ਜਿਵੇਂ ਕਿ ਖਿਡੋਣੇ ਬੱਚਿਆਂ ਦੇ ਕੱਪੜੇ ਆਦਿ ਮਿਲ ਜਾਂਦੇ ਹਨ ਲੁਧਿਆਣੇ ਵਿੱਚ ਮੋਂਟੀ ਕਾਰਲੋ ਆਦਿ ਦਾ ਸ਼ੋ ਰੂਮ ਹਨ ਜਿਸ ਵਿੱਚ ਕੱਪੜੇ ਔਰ ਘਰ ਕੱਪੜੇ ਡਰੈਸਿਸ ਵਗੈਰਾ ਸਕੂਲ ਡਰੈਸਿਸ ਹਰੇਕ ਆਈਟਮ ਮਿਲ ਜਾਂਦੀ ਹੈ ਇਸ ਤੋਂ ਇਲਾਵਾ ਕਲੱਬ ਰੋਪੜ ਵਿੱਚ ਇੱਕ ਹਵੇਲੀ ਹੈ ਜਿਸ ਵਿੱਚ ਖਾਣ ਪੀਣ ਦਾ ਸਾਰਾ ਸਮਾਨ ਮਿਲ ਜਾਂਦਾ ਹੈ ਔਰ ਉਸ ਤੋਂ ਇਲਾਵਾ ਸਿੱਧੂ ਰੈਸਟੋਰੈਂਟ ਮਹਿਫਲ ਏ ਪੰਜਾਬ ਰਾਜ ਢਾਬਾ ਆਦਿ ਸਾਰੇ ਮਸ਼ਹੂਰ ਹਨ